ਭਾਰਤ ਵਿੱਚ ਨੌਕਰੀਆਂ ਦੀਆਂ ਸਥਿਤੀਆਂ ਬਹੁਤ ਖਰਾਬ ਹੋ ਗਈਆਂ ਹਨ ਕਿਉਂਕਿ ਸਾਡੇ ਭਾਰਤ ਵਿੱਚ ਲੋਕ ਬਹੁਤ ਜ਼ਿਆਦਾ ਹਨ ਅਤੇ ਨੌਕਰੀਆਂ ਬਹੁਤ ਘੱਟ ਹਨ ਇਹ ਇਹੋ ਇਹੋ ਕਰਕੇ ਵਧੀਆ ਵਧੀਆ ਤੋਂ ਵਧੀਆ ਸਟੂਡੈਂਟਸ ਨੂੰ ਵੀ ਸੈਕਰੀਫਾਈਸ ਅਤੇ ਸਟਰਗਲ ਕਰਨਾ ਪੈ ਰਿਹਾ ਏ ਜਿਵੇਂ ਕਿ ਕਾਫੀ ਪਰਸੈਂਟੇਜ ਵਾਲੇ ਲੋਕ ਨੇ ਅਤੇ ਉਹਨਾਂ ਨੂੰ ਨੌਕਰੀਆਂ ਬਹੁਤ ਘੱਟ ਮਿਲ ਰਹੀਆਂ ਹਨ ਇਹ ਇਸ ਲਈ ਸਰਕਾਰ ਨੂੰ ਇਹ ਕਰਨਾ ਚਾਹੀਦਾ ਕਿ ਜਾਂ ਤਾਂ ਜੇ ਤਾਂ ਜਾਂ ਤਾਂ ਨੌਕਰੀਆਂ ਵਧਾਉਣੀਆਂ ਚਾਹੀਦਾ ਹਨ ਜਾਂ ਤਾਂ ਜਿਹੜੇ ਲੋਅ ਕਾਸਟ ਵਾਲੇ ਬੰਦੇ ਨੇ ਉਹਨਾਂ ਨੂੰ ਨੌਕਰੀਆਂ ਘੱਟ ਦੇਣੀ ਚਾਹੀਦੀਆਂ ਹਨ ਸਾਨੂੰ ਇਹ ਸਾਨੂੰ ਇਸ ਦੇ ਬਾਰੇ ਦੇਖਣਾ ਚਾਹੀਦਾ ਹੈ ਕਿ ਜੇ ਨੌਕਰੀਆਂ ਸਾਨੂੰ ਨਹੀਂ ਮਿਲ ਰਹੀ ਅਤੇ ਸਾਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਹੈ ਕਦੇ ਨਾ ਕਦੇ ਕਿਸੇ ਨਾ ਕਿਸੇ ਨੂੰ ਨੌਕਰੀ ਮਿਲ ਜਾਣੀ ਹੈ ਜੇ ਅਸੀਂ ਇਵੇਂ ਹਾਰ ਕੇ ਬਹਿ ਜਾਂਗੇ ਤਾਂ ਫਿਰ ਤਾਂ ਸਾਡੇ ਸਾਡਾ ਸਾਨੂੰ ਕੁਛ ਨਹੀਂ ਮਿਲਣਾ ਅਤੇ ਸਾਨੂੰ ਬਸ ਟਰਾਈ ਕਰਦੇ ਰਹਿਣਾ ਚਾਹੀਦੀ ਆ ਬਾਕੀ ਆਹ ਮੈਸੇਜ ਜਿਹੜਾ ਪੜ੍ਹ ਰਿਹਾ ਏ ਮੈਂ ਮੇਰੀ ਪੰਜਾਬੀ ਉੱਨੀ ਵਧੀਆ ਨਹੀਂ ਹੈ ਬਟ ਮੈਂ ਟਰਾਈ ਕਰ ਰਿਹਾ ਅਤੇ ਥੈਂਕ ਯੂ ਫੋਰ ਗਿਵਿੰਗ ਵਿਦ ਦਿਸ ਔਪਰਚੁਨੀਟੀ ਐਂਡ ਆਏ ਐਮ ਦਾ ਬੈਸਟ ਇਨ ਦਿਸ ਵਲਡ